ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕੋਣ ਜੀ ਹਾਂ ਪਛਾਣ ਲਿਆ ਪਛਾਣ ਲਿਆ ਹੋਰ ਸੁਣਾਓ ਭੈਣ ਜੀ ਕਿਆ ਹਾਲ ਚਾਲ ਬੜੇ ਟੈਮ ਬਾਅਦ ਤੁਸੀਂ ਫ਼ੋਨ ਕੀਤਾ ਜੀ ਹੋਰ ਸਭ ਠੀਕ ਠਾਕ ਮਹਾਰਾਜ ਦੀ ਕ੍ਰਿਪਾ ਨਾਲ ਸਭ ਵਧੀਆ ਤੁਸੀਂ ਦੱਸੋ ਜੀ

ਸਾਰੇ ਹੀ ਠੀਕ ਹੈ ਜੀ ਪੋਤੇ ਪੋਤੀਆਂ ਵੀ ਠੀਕ ਹੈ ਤੁਸੀਂ ਦੱਸੋ ਜੀ ਬਸ ਵਿਹਲੇ ਜੀ ਹਾਂਜੀ ਹਾਂਜੀ ਦੱਸੋ ਜੀ ਭੈਣ ਜੀ ਸਾਡੇ ਗੁਆਂਢੀਆਂ ਦਾ ਬੱਚਾ ਵੀ ਗਿਆ ਸੀਗਾ ਇੱਦਾਂ ਹੀ ਜਿੱਦ ਕਰਕੇ ਇ ਬਾਹਰਲੇ ਦੇਸ਼ਾਂ 'ਚ ਕੁਛ ਨਹੀਂ ਹੈਗਾ ਜੀ ਉੱਥੇ ਜਾਕੇ ਵੀ ਤਾਂ ਦਿਹਾੜੀਆਂ ਹੀ ਕਰਨੀਆਂ ਜੇ ਬੱਚੇ ਪੜ੍ਹ ਲਿਖ ਕੇ ਇੱਥੇ ਲੱਗ ਜਾਣ ਨੌਕਰੀ ਤਾਂ ਸਭ ਤੋਂ ਚੰਗੀ ਗੱਲ ਹੈ ਜੀ ਪਰ ਬੱਚੇ ਤਾਂ ਬਾਹਰ ਦੀ ਜਿੱਦ ਫੜ੍ਹ ਕੇ ਬਹਿ ਜਾਂਦੇ ਨੇ ਕਿ ਨਹੀਂ ਅਸੀਂ ਤਾਂ ਜੀ ਬਾਹਰ ਏ ਜਾਣਾ ਪਹਾੜ ਦੂਰੋਂ ਹੀ ਸੋਹਣੇ ਲੱਗਦੇ ਹੁੰਦੇ ਜੀ ਪਰ ਜਦੋਂ ਕੋਲ ਜਾਂਦੇ ਫਿਰ ਬਹੁਤ ਦਿੱਕਤਾਂ ਆਉਂਦੀਆਂ ਕੁੜੀਆਂ ਨੂੰ ਜ਼ਿਆਦਾ ਸਮੱਸਿਆਵਾਂ ਜੀ ਬਾਹਰ ਜਾ ਕੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਜੀ ਪਰ ਦੇਖੋ ਪੰਜਾਬ 'ਚ ਠੀਕ ਹੈ ਪੰਜਾਬ ਦੇ ਹਾਲਾਤ ਥੋੜ੍ਹੇ ਨਸ਼ੇ ਕਰਕੇ ਇੱਦਾਂ ਦੇ ਪਰ ਇਹ ਥੋੜ੍ਹੇ ਨਾ ਕਿ ਅਸੀਂ ਬਾਹਰ ਨੂੰ ਹੀ ਭੱਜੀਏ ਅਸੀਂ ਉਹ ਅਸੀਂ ਜਿਹੜੀ ਇਹ ਨਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੇ ਤਾਂ ਠੀਕ ਕਰਨਾ ਜੇ ਇਹ ਹੀ ਚਲੇ ਜਾਉਂਗੇ ਬਾਹਰ ਤਾਂ ਫਿਰ ਕਿੱਦਾਂ ਜੀ ਪੰਜਾਬ ਕਿੱਦਾਂ ਚੱਲੂੰਗਾ ਹਾਂਜੀ ਦੇਖਲੋ ਜੀ ਬੱਚੀ ਨੂੰ ਸਮਝਾ ਕੇ ਜੇ ਤਾਂ ਰੁਕਦੀ ਹੈ ਤਾਂ ਰੁਕ ਜਾਓ ਨਹੀਂ ਤਾਂ ਜੀ ਫਿਰ ਬੱਚਿਆਂ ਅੱਗੇ ਜਿੱਦ ਵੀ ਨਹੀਂ ਮਾਪੇ ਵੀ ਕਿਆ ਕਰ ਸਕਦੇ ਹੈ ਜੀ ਠੀਕ ਹੈ ਭੈਣ ਜੀ ਠੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ